ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਬਰਨਾਲਾ ਕਲੱਬ ਤੋਂ ਬੋਲ ਰਹੇ ਹੋ ਜੀ ਤੁਸੀਂ ਜੀ ਮੈਂ ਨਾ ਮੇਰੇ ਬੱਚੇ ਨੇਗੇ ਦੋ ਇੱਕ ਲੜਕਾ ਅਤੇ ਇੱਕ ਲੜਕੀ ਹੈ ਨਾ ਸਕੂਲ ਤੋਂ ਆ ਕੇ ਫੋਨ ਚਲਾਉਂਦੇ ਰਹਿੰਦੇ ਨੇਗੇ ਵੀ ਬਿਲਕੁਲ ਵੀ ਉਹ ਨਹੀਂ ਕਰਦੇ ਹੈਗੇ ਖੇਡ ਵੱਲ ਧਿਆਨ ਨਹੀਂ ਦਿੰਦੇ ਹੈਗੇ ਗੇ ਅਤੇ ਮੈਂ ਸੋਚਿਆ ਵੀ ਚੱਲੋ ਉਹਨਾਂ ਨੂੰ ਕੋਈ ਐਕਟੀਵਿਟੀ 'ਚ ਪਾ ਦੇਵਾਂ ਅਤੇ ਕੋਈ ਮਤਲਬ ਕਿ ਬੀਜੀ ਰੱਖਾਂ ਅੱਛਾ ਹਾਂਜੀ ਬੇਟੇ ਨੂੰ ਤਾਂ ਜੀ ਉਹਦਾ ਮਤਲਬ ਕਿ ਡਾਂਸ ਦਾ ਸ਼ੌਂਕ ਹੈਗਾ ਜੀ ਉਹ ਡਾਂਸ ਨੂੰ ਅਤੇ ਲੜਕੀ ਲਈ ਅਸੀਂ ਕੀ ਮਤਲਬ ਕਿ ਕਿਹੜਾ ਉਹ ਐਕਟੀਵਿਟੀ ਦੇ ਸਕਦੇ ਹੋ ਲੜਕੀ ਨੂੰ ਅੱਛਾ ਜੀ ਹਾਂਜੀ ਵੀ ਮਤਲਬ ਕਿ ਹਾਂਜੀ ਮਤਲਬ ਸਕੂਲ ਤੋਂ ਆ ਕੇ ਬਸ ਫੋਨ ਚਲਾਉਂਦੇ ਰਹਿੰਦੇ ਨੇ ਬਿਲਕੁਲ ਵੀ ਨਹੀਂ ਐਕਟੀਵਿਟੀ ਵੱਲ ਧਿਆਨ ਦਿੰਦੇ ਹੈਗੇ ਗੇ ਇਸ ਕਰਕੇ ਸੋਚਿਆ ਕਿ ਚੱਲ ਬਰਨਾਲਾ ਕਲੱਬ 'ਚ ਲਗਾ ਦਿੰਦੇ ਹੈਗੇ ਵੀ ਉੱਥੇ ਚੱਲ ਐਕਟੀਵਿਟੀ ਕਰਨਗੇ ਨਾ ਥੋੜ੍ਹਾ ਘੰਟਾ ਮਤਲਬ ਜਿਹੜਾ ਟਾਈਮ ਬਿਜੀ ਰਹਿਣਗੇ ਤਾਂ ਠੀਕ ਹੀ ਰਹਿਣਗੇ ਠੀਕ ਹੈ ਟਾਈਮਿੰਗ ਕੀ ਹੈ ਜੀ ਅੱਛਾ ਅੱਛਾ ਜੀ ਠੀਕ ਹੈ ਹਾਂਜੀ ਅਸੀਂ ਠੀਕ ਹੈ ਜੀ ਅਸੀਂ ਕੱਲ੍ਹ ਨੂੰ ਆਵਾਂਗੇ ਨਾਲੇ ਫੀਸ ਦੀ ਗੱਲ ਕਰਕੇ ਜਾਵਾਂਗੇ ਅਤੇ ਨਾਲੇ ਬੱਚੇ ਵਿਜ਼ਿਟ ਕਰ ਓਕੇ ਜੀ ਠੀਕ ਹੈ ਜੀ ਵੈਲਕਮ